ਰਨਿੰਗ ਟਰੇਲ ਰਨਿੰਗ ਵਿੱਚ ਪਹਿਲਾਂ ਮੈਂ ਬੜੀ ਕੋਸ਼ਿਸ਼ ਕਰਦਾ ਹੁੰਦਾ ਸੀ ਦੌੜਨ ਦੇ ਵਿੱਚ ਸਿਹਤ ਨੂੰ ਤੰਦਰੁਸਤ ਰੱਖਣ ਲਈ ਬੜੀ ਸਹਾਇਤਾ ਮਿਲਦੀ ਹੈ ਖੇਡਾਂ ਦੌੜ ਅਤੇ ਹੋਰ ਸਾਰੀਆਂ ਵੀ ਖੇਡਾਂ ਬੰਦੇ ਦੀ ਤੰਦਰੁਸਤੀ ਲਈ ਜ਼ਿੰਦਗੀ ਵਿੱਚ ਬੜਾ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ ਇਸ ਨਾਲ ਹਰ ਵੇਲੇ ਸਰੀਰ ਤੰਦਰੁਸਤੀ ਵਿੱਚ ਰਹਿਣ ਦੀ ਸਹਾਇਤਾ ਮਿਲਦੀ ਹੈ